ਵੈਬਸਾਈਟ ਦੇ ਹੋਮਪੇਜ ਉੱਤੇ ਮੌਜੂਦ ਖੋਜ ਬਾਰ ਵਿੱਚ ਆਪਣੇ ਚਾਹੀਦੇ ਸਮਾਟਫੋਨ ਦਾ ਨਾਮ ਲਿਖੋ ਅਤੇ ਖੋਜ ਬਟਣ ਜਾਂ ਇੰਟਰ ਦਬਾਓ ਖੋਜ ਨਤੀ ਨਤੀਜਿਆਂ ਵਿੱਚੋਂ ਆਪਣੇ ਪਸੰਦੀਦਾ ਸਮਾਟਫੋਨ ਨੂੰ ਚੁਣੋ ਅਤੇ ਉਸਦੇ ਉੱਤੇ ਕਲਿੱਕ ਕਰੋ ਮੋਡਲ ਵਿਸ਼ੇਸ਼ਤਾਵਾਂ ਕੀਮਤ ਰਿਵਿਊਜ ਆਦਿ ਨੂੰ ਧਿਆਨ ਨਾਲ ਪੜ੍ਹੋ ਜਾਂ ਤਾਂ ਜੋ ਤੁਹਾਡੀ ਚੋਣ ਸਹੀ ਹੋਵੇ ਐਡ ਟੂ ਕਾਰਟ ਜਾਂ ਕਾਰਟ ਵਿੱਚ ਸ਼ਾਮਲ ਕਰੋ ਬਟਨ 'ਤੇ ਕਲਿੱਕ ਕਰੋ ਵੈਬਸਾਈਟ ਦੇ ਸ਼ੋਪਿੰਗ ਕਾਰਟ ਆਈਕਨ 'ਤੇ ਕਲਿੱਕ ਕਰਕੇ ਯਕੀਨੀ ਬਣਾਓ ਕਿ ਤੁਹਾਡਾ ਸਮਾਟਫੋਨ ਸਹੀ ਤਰੀਕੇ ਨਾਲ ਕਾਰਟ ਵਿੱਚ ਸ਼ਾਮਲ ਹੋ ਗਿਆ ਹੈ ਤੁਸੀਂ ਤੁਰੰਤ ਚੈਕਆਊਟ ਕਰ ਸਦਕੇ ਹੋ ਜਾਂ ਬਾਅਦ ਵਿੱਚ ਖਰੀਦਣ ਲਈ ਉਤਪਾਦ ਨੂੰ ਕਾਰਟ ਵਿੱਚ ਹੀ ਛੱਡ ਸਕਦੇ ਹੋ